ਜੂਠੇ ਭਾਂਡੇ ਮੈਂ ਸਿੱਧਾ ਨਹੀਂ ਧੋਂਦੀ ਮੈਂ ਸ਼ੈਂਕ 'ਚ ਪਾਣੀ ਪਾ ਕੇ ਰੱਖ ਦਿੰਦੀ ਹਾਂ ਤਾਂ ਕਿ ਮੈਨੂੰ ਬਾਅਦ 'ਚ ਮੁਸ਼ਕਲ ਜਾਂ ਕੋਈ ਦਿੱਕਤ ਨਾ ਆਵੇ ਭਾਂਡੇ ਧੋਣ ਦੇ ਵਿੱਚ ਫਿਰ ਉਹਨਾਂ ਨੂੰ ਮੈਂ ਸਾਈਡ ਤੇ ਕੱਢ ਕੇ ਰੱਖ ਦਿੰਦੀ ਹਾਂ ਸਾਡੇ ਘਰ ਦੋ ਸ਼ੈਂਕ ਨੇ ਇੱਕ ਸੈਂਕ 'ਚ ਗਿੱਲੇ ਭਾਂਡੇ ਜੂਠੇ ਭਾਂਡੇ ਅਤੇ ਇੱਕ ਸਾਈਡ 'ਤੇ ਅਸੀਂ ਸੁੱਕੇ ਧੋ ਕੇ ਪਾ ਦਿੰਦੇ ਹਾਂ ਜਿਹਦੇ ਨਾਲ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਫਿਰ ਅਸੀਂ ਭਾਂਡਿਆਂ ਨੂੰ ਵਿਮ ਸਾਬਣ ਦੇ ਨਾਲ ਧੋ ਦਿੰਦੇ ਹਾਂ ਵਿੰਮ ਸਾਬਣ ਦੇ ਨਾਲ ਧੋਣ ਤੋਂ ਬਾਅਦ ਮੈਂ ਸਾਰੇ ਚੰਗੀ ਤਰ੍ਹਾਂ ਬਰਾਈਟ ਬਰੋਜ ਦੇ ਨਾਲ ਧੋ ਕੇ ਸਾਈਡ 'ਤੇ ਰੱਖ ਦਿੰਦੀ ਹਾਂ ਸੁੱਕੇ ਵਾਲੀ ਸਾਈਡ ਨਾਲ ਨਾਲ ਭਾਂਡੇ ਸੁੱਕਦੇ ਜਾਂਦੇ ਆ ਜਿਹਦੇ ਨਾਲ ਅਤੇ ਤੇਲ ਵਾਲੇ ਬਰਤਨਾਂ ਨੂੰ ਦੋ ਤਰ੍ਹਾਂ ਦੇ ਤਰੀਕੇ ਨਾਲ ਅਸੀਂ ਸਾਫ਼ ਕਰ ਸਕਦੇ ਹਾਂ ਦੋ ਤਰ੍ਹਾਂ ਦੇ ਭਾਵ ਵਿਭਾਗ ਨੇ ਸਾਡੇ ਕੋਲ ਇੱਕ ਹੈਗਾ ਆ ਕਿ ਅਸੀਂ ਗਰਮ ਪਾਣੀ ਦੇ ਵਿੱਚ ਪਾ ਕੇ ਆਰਾਮ ਨਾਲ ਚੰਗੀ ਤਰ੍ਹਾਂ ਸਾਫ਼ ਹੋ ਜਾਂਦੇ ਆ ਇੱਕ ਹੈਗਾ ਵਾ ਸਟੀਲ ਵੂਲ ਉਹਦੇ ਨਾਲ ਵੀ ਅਸੀਂ ਆਰਾਮ ਨਾਲ ਭਾਂਡੇ ਸਾਫ਼ ਕਰ ਸਕਦੇ ਹਾਂ ਤੇਲ ਕੋਈ ਵੀ ਚੀਜ਼ ਜੰਮੀ ਹੋਵੇ ਭਾਵੇਂ ਦਾਲ ਜੰਮੀ ਹੋਵੇ ਸਾਰਾ ਕੁਛ ਚੰਗੀ ਤਰ੍ਹਾਂ ਸਟੀਲ ਵੂਲ ਨਾਲ ਨਿਕਲ ਜਾਂਦਾ ਭਾਵੇਂ ਭਾਂਡਾ ਸੜ ਗਿਆ ਹੋਵੇ ਅਤੇ ਇਸ ਨਾਲ ਤੇਲ ਵਾਲਾ ਸਾਰਾ ਕੁਛ ਸਾਫ਼ ਹੋ ਜਾਂਦਾ ਹੈ